ਲੋਕ ਵਿਆਹ ਦੇ ਵਿੱਚ ਜੋ ਬੜੀ ਪੁਰਾਣੀ ਸਦੀਆਂ ਤੋਂ ਹੀ ਪੈਸ ਅਨੁਵਾਦ ਚੱਲਿਆ ਆ ਰਿਹਾ ਹੈ ਇਹਦੇ ਵਿੱਚ ਲਾੜੀ ਨੂੰ ਘਰ ਦਾ ਸਮਾਨ ਰਸੋਈ ਦਾ ਸਮਾਨ ਸਜ ਧਜ ਕੇ ਰਹਿਣ ਵਾਸਤੇ ਜੋ ਗਹਿਣੇ ਹੈ ਜਾਂ ਕੱਪੜੇ ਹੈ ਇਸ ਤਰ੍ਹਾਂ ਦੇ ਤੋਹਫੇ ਦਿੱਤੇ ਜਾਂਦੇ ਹਨ ਇਸ ਤੋਂ ਇਲਾਵਾ ਵੀ ਕੋਈ ਜਿਹਨੇ ਅੱਛਾ ਅੱਛੇ ਮਜ਼ਬੂਤ ਬੈਂਕ ਬੈਲਸ ਹੈ ਜਿਹਨਾਂ ਦਾ ਔਰ ਬੜੇ ਬੜੇ ਅੱਛੇ ਅੱਛੇ ਤੋਹਫੇ ਵੀ ਦਿੰਦੇ ਹਨ ਜੋ ਕਿ ਲਾੜੀ ਨੂੰ ਆਪਣੀ ਜ਼ਿੰਦਗੀ ਬਿਤਾਉਣ ਵਿੱਚ ਬੜਾ ਸਹਾਈ ਹੁੰਦੇ ਹੈ ਤਾਂ ਉਹ ਆਪਣਾ ਜ਼ਿੰਦਗੀ ਜੀਵਨ ਸਫਰ ਅੱਛੀ ਤਰ੍ਹਾਂ ਬੀਤਾ ਸਕਦੀ ਹੈ